ਪੰਜਾਬ ਦਾ ਮੋਹਾਲੀ ਜ਼ਿਲ੍ਹਾ ਬਹੁਤ ਹੀ ਤੇਜ਼ੀ ਨਾਲ਼ ਵਧਣ ਫੁੱਲਣ ਵਾਲਾ ਇਲਾਕਾ ਹੈ ਇਸ ਵਿੱਚ ਬੁ ਬਜ਼ੁਰਗ ਆਬਾਦੀ ਦਾ ਬਹੁਤ ਜ਼ਿਆਦਾ ਹਿੱਸਾ ਵੱਸ ਰਿਹਾ ਹੈ ਕਿਉਂਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇੱਥੇ ਲੋਕ ਆਪਣੇ ਨੌਕ ਨੌਕਰੀ ਨੌਕਰੀ ਕਰਨ ਲਈ ਆਉਂਦੇ ਹਨ ਜਿਸ ਕਾਰਨ ਇੱਥੇ ਬਹੁਤ ਜ਼ਿਆਦਾ ਅਬਾ ਆਬਾਦੀ ਦਾ ਹਿੱਸਾ ਜਿਹੜਾ ਹੈ ਉਹ ਨੌਕਰੀ ਪੇਸ਼ਾ ਹੈ ਜਿਸ ਕਾਰਨ ਬਜ਼ੁਰਗ ਅਬਾਦੀ ਜਿਹੜੀ ਹੁੰਦੀ ਹੈ ਉਹ ਆਪਣੇ ਆਪ ਨੂੰ ਇਕੱਲਾਪਣ ਮਹਿਸੂਸ ਕਰਦੀ ਹੈ ਕਿਉਂਕਿ ਜ਼ਿਆਦਾਤਰ ਘਰਾਂ ਦੇ ਲੋਕ ਜੋ ਹੁੰਦੇ ਨੇ ਉਹ ਆਪਣੀ ਨੌਕਰੀ ਕਰਨ ਲਈ ਚਲੇ ਜਾਂਦੇ ਨੇ ਅਤੇ ਪਿੱਛੋਂ ਬਜ਼ੁਰਗ ਘਰ ਇਕੱਲੇ ਰਹਿ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਜਿਹੜੀ ਸਿਹਤ ਦੀ ਦੇਖ ਰੇਖ ਸਮਾਜਿਕ ਵਗੈਰਾ 'ਚ ਵਿਚਰਨ ਦਾ ਅਤੇ ਸਨਮਾਨ ਦਾ ਹਿੱਸਾ ਹੁੰਦਾ ਜਿਹੜਾ ਉਹ ਖੁਸ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਆਪਣੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਵੀ ਵੱਧ ਤੋਂ ਵੱਧ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਟਾਈਮ ਦੇਣ ਅਤੇ ਉਹਨਾਂ ਦਾ ਸਨਮਾਨ ਕਰਨ ਉਹਨਾਂ ਦੀ ਸਹਾਇਤਾ ਕਰਨ ਤਾਂ ਕਰਕੇ ਉਹਨਾਂ ਦੀ ਜਿਹੜੀ ਇਕੱਲਾਪਣ ਹੈ ਉਹ ਦੂਰ ਹੋ ਸਕਦਾ ਹੈ